ਪੰਜਾਬੀ ਲੋਕ ਆਪਣੀਆਂ ਸੱਭਿਆਚਾਰਕ ਪਰੰਪਰਾਵਾਂ ਨੂੰ ਮਨਾਉਣ ਅਤੇ ਸਨਮਾਨ ਦੇਣ ਲਈ ਆਪਣੀ ਭਾਸ਼ਾ ਦੀ ਵਰਤੋਂ ਜਿਵੇਂ ਕਿ ਵਿਆਹ ਸ਼ਾਦੀਆਂ ਗੁਰਦੁਆਰਿਆਂ ਵਿਸਾਖੀ ਤਿਉਹਾਰ ਆਪਸੀ ਮੇਲ ਜੋਲ ਵਿੱਚ ਆਪ ਪੰਜਾਬੀ ਵਿੱਚ ਗੱਲ ਕਰਦੇ ਆ ਪੰਜਾਬੀ ਪਹਿਰਾਵਾ ਪਾਉਂਦੇ ਆ ਜਿੱਦਾਂ ਵਿਆਹ ਸ਼ਾਦੀਆਂ ਹੁੰਦੀਆਂ ਹੈ ਤਾਂ ਉਹਨਾਂ ਵਿੱਚ ਘੋੜੀਆਂ ਗਾਈਆਂ ਜਾਂਦੀਆਂ ਸੁਹਾਗ ਗਾਏ ਜਾਂਦੇ ਹੈ ਕਾਫ਼ੀ ਦਿਨ ਪਹਿਲਾਂ ਹੀ ਗਾਉਣੇ ਸ਼ੁਰੂ ਕਰ ਦਿੰਦੇ ਹੈ ਫਿਰ ਜਦੋਂ ਗੁਰਦੁਆਰੇ ਵਿੱਚ ਜਾਂਦੇ ਹੈ ਤਾਂ ਉੱਥੇ ਕੀਰਤਨ ਹੁੰਦੇ ਹੈ ਸ਼ਬਦ ਗਾਏ ਜਾਂਦੇ ਹੈ ਮੱਥਾ ਟੇਕਿਆ ਜਾਂਦਾ ਹੈ ਪੰਜਾਬੀ ਵਿੱਚ ਅਸੀਂ ਹਮੇਸ਼ਾ ਗੱਲਬਾਤ ਕਰਦੇ ਆ ਫੈਮਲੀ ਵਿੱਚ ਤਿਉਹਾਰਾਂ 'ਤੇ ਅਸੀਂ ਪੰਜਾਬੀ ਕੱਪੜੇ ਪਾਉਂਦੇ ਹੈ ਗੀਤ ਗਾਉਂਦੇ ਹੈ ਭੰਗੜਾ ਹੁੰਦਾ ਹੈ ਗਿੱਧਾ ਹੁੰਦਾ ਹੈ ਜੋ ਸਾਡੇ ਪੰਜਾਬੀਆਂ ਦੀ ਪਹਿਚਾਣ ਹੈ ਆਪਸੀ ਮੇਲ ਜੋਲ ਹੁੰਦਾ ਹੈ ਸਾਡਾ ਪੰਜਾਬੀਆਂ ਦਾ ਉਹਦੇ ਵਿੱਚ ਇਕੱਠੇ ਬੈਠ ਕੇ ਪੰਜਾਬੀ ਵਿੱਚ ਗੱਲਬਾਤ ਕਰਦੇ ਹੈ ਇਸ ਤਰ੍ਹਾਂ ਅਸੀਂ ਆਪਣੀ ਪੰਜਾਬੀ ਭਾਸ਼ਾ ਦਾ ਸਨਮਾਨ ਕਰਦੇ ਹਾਂ